ਅੱਜ ਕੱਲ੍ਹ ਦੇ ਬੱਚੇ ਬਹੁਤ ਹੀ ਜ਼ਿਆਦਾ ਨਵੀਆਂ ਗੇਮਾਂ ਖੇਡਦੇ ਹਨ ਫ੍ਰੀ ਫਾਇਰ ਪੱਬਜੀ ਅਤੇ ਉਸ ਤੋਂ ਇਲਾਵਾ ਕ੍ਰਿਕਟ ਹੋ ਗਈ ਫੁੱਟਬੋਲ ਹੋਕੀ ਬੈਡਮਿੰਟਨ ਚਿੱੜੀ ਛਿੱਕਾ ਵਗੈਰਾ ਬਹੁਤ ਹੀ ਹੋਰ ਖੇਡਾਂ ਖੇਡਦੇ ਹਨ